ਉਹ ਮੈਂ ਆਖਰੀ ਮਹੀਨੇ ਅ ਔਨਲਾਈਨ ਇੰਸਟਾਗਰਾਮ ਸੋਸ਼ਲ ਮੀਡੀਆ ਚੈਨਲ ਹੈ ਉਸ 'ਤੇ ਇੱਕ ਸ਼ੂਜ਼ ਦੇਖੇ ਸੀ ਮੈਨੂੰ ਕਾਫੀ ਪਸੰਦ ਆਇਆ ਡਿਜ਼ਾਇਨ ਉਨ੍ਹਾਂ ਨੇ ਫੋਟੋਜ਼ ਵਗੈਰਾ ਡਾਕੂਮੈਂਟ ਕਾਫੀ ਚੰਗੀ ਤਰ੍ਹਾਂ ਕੀਤੀਆਂ ਸੀ ਬ੍ਰੈਂਡ ਨਵਾਂ ਸੀ ਬਟ ਮੈਂ ਫਿਰ ਵੀ ਸੋਚਿਆ ਚਲੋ ਟਰਾਈ ਕਰਦੇ ਹਾਂ ਕਿਉਂਕਿ ਰੇਟ ਕਾਫੀ ਜੈਨੁਇਨ ਰੀਜ਼ਨੇਬਲ ਸੀ ਅਤੇ ਦੇਖਣ 'ਚ ਫੋਟੋਸ ਤੋਂ ਕਾਫੀ ਅੱਛੇ ਲੱਗ ਰਹੇ ਸਨ ਪਰ ਜਦੋਂ ਡਿਲੀਵਰ ਹੋਇਆ ਅੋਰਡਰ ਤਾਂ ਵੇਖਣ 'ਚ ਬਿਲਕੁਲ ਹੀ ਠੀਕ ਸੀਗੇ ਬਿਲਕੁਲ ਉਦਾਂ ਹੀ ਸੀਗੇ ਮਟੀਰੀਅਲ ਵੀ ਹੱਥ ਲਾ ਕੇ ਕਾਫੀ ਵਧੀਆ ਲੱਗ ਰਿਹਾ ਸੀ ਬਟ ਪਾਉਣ 'ਚ ਉੱਨੇ ਕੰਫਰਟੇਬਲ ਨਹੀਂ ਸੀਗੇ ਅਤੇ ਉਹ ਥੋੜ੍ਹਾ ਜਿਹਾ ਮਤਲਬ ਰਿਹਾ ਕਿ ਬਾਕੀ ਜਿੰਨੇ ਵੀ ਮੈਂ ਸ਼ੂਜ਼ ਚਾਹੇ ਔਨਲਾਈਨ ਲਏ ਕਿਤੋਂ ਹੋਰ ਵੀ ਲਏ ਉਹ ਪਾਉਣ 'ਚ ਬਿਲਕੁਲ ਕੰਫਰਟੇਬਲ ਰਹਿੰਦੇ ਬਟ ਇਹਨਾਂ 'ਚ ਥੋੜ੍ਹਾ ਪਾਉਣ ਦਾ ਥੋੜ੍ਹਾ ਉੱਨਾ ਕੰਫਰਟ ਨਹੀਂ ਮਿਲਿਆ